ਜਿਵੇਂ ਕਿ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਚੀਜ਼ ਕਲੈਕਟ ਕਰਨ ਦਾ ਸ਼ੌਂਕ ਹੁੰਦਾ ਉਵੇਂ ਮੈਨੂੰ ਸ਼ੌਂਕ ਸੀ ਚੀਜ਼ ਕਲੈਕਟ ਕਰਨ ਦਾ ਜਿਵੇਂ ਮੈਂ ਛੋਟੀ ਸੀ ਉਦੋਂ ਮੈਨੂੰ ਕੋਇਨ ਕਲੈਕਟ ਕਰਨ ਦਾ ਸ਼ੌਂਕ ਸੀ ਉਹ ਮੈਂ ਕੋਇਨ ਕਲੈਕਟ ਕਰਕੇ ਆਪਦੀ ਪੀਗੀ ਬੈਂਕ ਵਿੱਚ ਰੱਖਦੀ ਹੁੰਦੀ ਸੀ ਜਦੋਂ ਮੇਰੇ ਪੇਰੈਂਟਸ ਨੇ ਮੈਨੂੰ ਕੋਇਨ ਦੇਣੇ ਜਾਂ ਮੈਂ ਉਹਨਾਂ ਤੋਂ ਲੈਣੇ ਤਾਂ ਉਹ ਸਾਰੇ ਚੀਜ਼ਾਂ ਚੀਜ਼ ਲੈਣ ਲਈ ਮੈਂ ਰੱਖਦੀ ਹੁੰਦੀ ਸੀ ਤੇ ਪਿਗੀ ਬੈਂਕ ਵਿੱਚ ਤੇ ਜਿਵੇਂ ਜਿਵੇਂ ਵੱਡੇ ਹੋਏ ਫੋ ਫੋਰਥ ਫਿਫਥ ਕਲਾਸ 'ਚ ਉਦੋਂ ਪੈੱਨ ਕਲੈਕਟ ਕਰਨ ਦਾ ਸ਼ੌਂਕ ਹੋ ਗਿਆ ਵੀ ਨਵੇਂ ਨਵੇਂ ਤਰਾਂ ਦੇ ਪੈੱਨ ਕਲੈਕਟ ਕਰਨੇ ਉਹਨਾਂ ਦੇ ਰਿਫਲਸ ਨੂੰ ਕੁਲੈਕਟ ਕਰਨਾ ਸਿੱਕੇ ਨਵੇਂ ਤਰ੍ਹਾਂ ਦੇ ਗਲਿਟਰ ਪੈਨਸ ਹੋ ਗਏ ਇਹ ਸਾਰੀਆਂ ਚੀਜ਼ਾਂ ਨੂੰ ਕਲੈਕਟ ਕਰਕੇ ਰੱਖਣਾ ਆਪਦੇ ਕੋਲੇ ਤੇ ਫਿਰ ਉਹ ਜਦੋਂ ਬਹੁਤ ਜਿਆਦਾ ਪੈਨ ਹੋ ਜਾਂਦੇ ਉਹਦੇ ਨਾਲ ਪੈੱਨ ਫਾਈਟਿੰਗ ਖੇਡਣੀ ਫਿਰ ਜਿਵੇਂ ਵੱਡੇ ਹੋਏ ਗਏ ਉਵੇਂ ਉਵੇਂ ਸ਼ੌਂਕ ਬਦਲੀ ਗਏ ਤੇ ਹੁਣ ਕਰੰਟਲੀ ਮੈਨੂੰ ਸੂਟ ਜੁੱਤੀਆਂ ਉਹਦੇ ਨਾਲ ਦੇ ਮੈਚਿੰਗ ਜੂਲਰੀ ਇਹ ਸਭ ਚੀਜ਼ਾਂ ਰੱਖਣ ਦਾ ਸ਼ੌਂਕ ਹੈ ਇਹ ਸਾਰੀ ਚੀਜ਼ਾਂ ਜਿਵੇਂ ਮੇਰੀ ਏਜ ਦੇ ਅਕੋਰਡਿੰਗ ਇਹ ਸਾਰੀਆਂ ਚੀਜ਼ਾਂ ਮੇਰੇ ਪਰਸਨਲ ਇੰਟਰਸਟ ਹੁੰਦਾ ਸੀ ਜਿਵੇਂ ਛੋਟੇ ਹੁੰਦੇ ਮੈਨੂੰ ਇੰਟਰਸਟ ਸੀ ਕਿ ਮੈਂ ਕੋਇਨ ਇਕੱਠੇ ਕਰਾਂ ਉਸਤੋਂ ਬਾਅਦ ਮੈਨੂੰ ਪੈਨ ਇਕੱਠੇ ਕਰਨ ਦਾ ਇੰਟਰਸਟ ਹੋ ਗਿਆ ਤੇ ਹੁਣ ਮੈਨੂੰ ਸੂਟ ਵਗੈਰਾ ਦਾ ਇੰਟਰਸਟ ਹੈ ਕਿਉਂਕਿ ਅੱਜ ਕੱਲ ਲੋਕ ਫੈਸ਼ਨ ਸੈਂਸ ਵੇਖਦੇ ਆ ਤੇ ਮੈਨੂੰ ਵੀ ਹੈਗਾ ਕਿ ਮੈਂ ਫੈਸ਼ਨ ਸੈਂਸ ਬਹੁਤ ਵਧੀਆ ਰੱਖਾਂ ਆਪਦੀ ਤੇ ਹੁਣ ਮੈਂ ਮੈਨੂੰ ਸੂਟ ਵਗੈਰਾ ਜਿਵੇਂ ਕੋਈ ਵੀ ਨਵੇਂ ਟਰੈਂਡ ਦਾ ਸੂਟ ਆਉਂਦਾ ਜਾਂ ਕੋਈ ਉਸ ਤਾਦ ਦੀ ਸਟਿਚਿੰਗ ਆਉਂਦੀ ਹ ਮੈਂ ਉਹਨਾਂ ਨੂੰ ਕਲੈਕਟ ਕਰਦੀ ਆਂ ਕੋਈ ਇੰਸਟਾਗਰਾਮ ਤੇ ਪੋਸਟ ਹੁੰਦੀ ਹ ਉਹਨੂੰ ਸੇਵ ਕਰ ਲੈਦੀ ਤਾਂ ਕਿ ਇਨ ਫਿਊਚਰ ਮੈਂ ਉਸ ਟਾਈਪ ਦਾ ਸੂਟ ਬਣਾ ਸਕਾਂ ਉਹਦੇ ਨਾਲ ਦੇ ਜੁੱਤੀਆਂ ਹੋ ਗਈਆਂ ਏਅਰਿੰਗਸ ਹੋ ਗਏ ਮਤਲਬ ਵਿਆਹ ਸ਼ਾਦੀ ਤੇ ਪਾਉਣ ਲਈ ਹੁਣ ਮੈਂ ਆਉਂਦਾ ਵੀ ਮੇਰਾ ਇੱਕ ਜਨੂਨ ਟਾਈਪ ਜਿਹਾ ਹੀ ਕਹਿ ਸਕਦੇ ਆ ਵੀ ਮੈਂ ਆਪਦੇ ਸੂਟ ਦੇ ਨਾਲ ਸਾਰੀ ਚੀਜ਼ ਮੈਚਿੰਗ ਹੀ ਪਾਉਣੀ ਹੈ ਤਾਂ ਕੀ ਮੈਂ ਅਟਰੈਕਟਿਵ ਲੱਗਾ